ਇੰਡੀਆ ਦਾ ਸਭ ਤੋਂ ਵੱਡਾ ਬਾਇਓਗੈਂਸ ਪਲਾਂਟ ਪੰਜਾਬ ਵਿੱਚ ਹੈ ਜੋ ਕਿ ਇਲਾਕਾ ਸੰਗਰੂਰ ਵਿੱਚ ਮੌਜੂਦ ਹੈ ਮੈਂ ਇਹ ਪਲਾਂਟ ਦੇਖਿਆ ਹੈ ਜੋ ਕਿ ਕਾਫੀ ਵੱਡਾ ਹੈ ਇਸ ਦਾ ਪੂਰਾ ਨਾਂ ਕੰਪ੍ਰੈਸਡ ਬਾਇਓਗੈਂਸ ਪਲਾਂਟ ਹੈ ਜੋ ਕਿ ਵੀਹ ਏਕੜ ਦੇ ਏਰੀਏ ਵਿੱਚ ਫੈਲਿਆ ਹੋਇਆ ਹੈ ਇਹ ਲੋਕਾਂ ਦੀ ਕਾਫੀ ਸਹਾਇਤਾ ਕਰਦਾ ਹੈ ਇਹ ਇੱਕ ਦਿਨ ਵਿੱਚ ਤਿੰਨ ਸੌ ਟਨ ਵੇਸਟ ਨੂੰ ਪ੍ਰੋਸੈਸ ਕਰਕੇ ਗੈਂਸ ਬਨਾਉਣ ਅਤੇ ਗੈਸ ਵਿੱਚ ਤਬਦੀਲ ਕੀਤਾ ਜਾਂਦਾ ਹੈ ਜੋ ਕਿ ਖਰਾਬ ਵੇਸਟ ਨੂੰ ਘੱਟ ਕਰਦਾ ਹੈ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਂਦਾ ਹੈ ਬਾਇਓਗੈਂਸ ਪਲਾਂਟ ਦੇ ਪ੍ਰੋਸੈਸ ਨੂੰ ਡਾਈਜੇਸ਼ਨ ਕਰਦੇ ਹਨ ਇਸ ਦੀਆਂ ਚਾਰ ਸੀਵਰੇਜ ਹੁੰਦੀਆਂ ਹਨ ਸਟੇਜਾਂ ਹੁੰਦੀਆਂ ਹਨ ਇਸ ਵਿੱਚ ਕਹਿੰਦੇ ਹਨ ਇਸ ਦੀਆਂ ਚਾਰ ਸਟੇਜਾਂ ਹੁੰਦੀਆਂ ਹਨ ਇਸ ਵਿੱਚ ਕਾਫੀ ਤਰ੍ਹਾਂ ਦਾ ਵੇਸਟ ਪ੍ਰੋਸੈਸ ਕਰਕੇ ਗੈਂਸ ਵਿੱਚ ਤਬਦੀਲ ਕੀਤਾ ਜਾਂਦਾ ਹੈ